ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਣਜੀਤ ਕੌਰ ਬੋਲਦੀ ਹਾਂ ਰੋਪੜ ਤੋਂ ਸਰ ਤੁਸੀਂ ਕਾਰ ਏਜੰਸੀ ਤੋਂ ਬੋਲਦੇ ਹੋ ਸਰ ਅਸੀਂ ਕਾਰ ਬੁੱਕ ਕਰਵਾਉਣੀ ਸੀ ਅਸੀਂ ਰੋਪੜ ਤੋਂ ਨੂਰਪੁਰ ਬੇਦੀ ਜਾਣਾ ਹੈ ਅਤੇ ਸਰ ਖਰਚਾ ਦੱਸ ਦਿਓ ਕਿੰਨਾਂ ਹੋਏਗਾ ਜੇ ਅਸੀਂ ਇੱਕ ਦਿਨ ਵਾਸਤੇ ਜਾਣਾ ਹੈ ਕਿੰਨਾਂ ਖਰਚਾ ਹੋਏਗਾ ਦੋ ਦਿਨ ਜਾਣਾ ਤਾਂ ਕਿੰਨਾਂ ਖਰਚਾ ਹੋਏਗਾ ਹਾਂਜੀ ਸਰ ਸਵੇਰੇ ਸ਼ੁਕਰਵਾਰ ਤੋਂ ਸਵੇਰੇ ਨਿਕਲਣਾ ਹੈ ਹਾਂਜੀ ਸਰ ਦੱਸ ਦਿਓ ਪਲੀਜ਼ ਓ